ਮੇਰੇ ਖੇਤਰ ਵਿੱਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਨੌਜਵਾਨ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਗੱਲ ਕਰਨ ਲਈ ਮਾਣ ਮਹਿਸੂਸ ਕਰਦੇ ਹਨ ਅੱਜ ਕੱਲ੍ਹ ਪੰਜਾਬ 'ਚ ਬਾਹਰ ਜਾਣ ਦਾ ਟਰੈਂਡ ਬਣਿਆ ਹੋਇਆ ਹੈ ਇਸ ਕਰਕੇ ਉਹ ਅੰਗਰੇਜ਼ੀ ਦੀ ਭਾਸ਼ਾ ਵੀ ਸਿੱਖਦੇ ਹਨ ਕਿਉਂਕਿ ਬਾਹਰ ਸੈਟਲ ਹੋਣ ਲਈ ਇੱਕ ਟੈਸਟ ਹੁੰਦਾ ਹੈ ਜੋ ਕਿ ਆਈਲੈਟਸ ਅਤੇ ਪੀ ਟੀ ਆਈ ਹੁੰਦਾ ਹੈ ਉਹ ਉਦੋਂ ਹੀ ਕਲੀਅਰ ਹੋ ਸਕਦਾ ਹੈ ਜਦੋਂ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਹੋਵੇ ਮੇਰੇ ਦੋਸਤ ਦਾ ਫਰੈਂਚ ਸਿਖਾਉਣ ਦਾ ਕੋਚਿੰਗ ਸੈਂਟਰ ਵੀ ਹੈ ਉਹਦੇ ਵਿੱਚ ਮੈਂ ਦੇਖਦਾ ਹੈ ਕਿ ਬਹੁਤ ਸਾਰੇ ਬੱਚੇ ਫਰੈਂਚ ਸਿੱਖ ਰਹੇ ਹਨ ਮੇਰੇ ਖੇਤਰ ਵਿੱਚ ਹਿੰਦੀ ਭਾਸ਼ਾ ਵੀ ਬੋਲੀ ਜਾਂਦੀ ਹੈ ਕਿਉਂਕਿ ਬੋਲੀਵੁੱਡ ਦੀਆਂ ਸਾਰੀਆਂ ਫਿਲਮਾਂ ਜੋ ਕਿ ਹਿੰਦੀ ਵਿੱਚ ਹੁੰਦੀਆਂ ਹਨ ਲੋਕ ਬੜੀ ਉਤਸੁਕਤਾ ਨਾਲ ਦੇਖਦੇ ਹਨ ਘਰ ਵਿੱਚ ਜਿੰਨੇ ਵੀ ਟੀ ਵੀ ਦੇ ਸੀਰੀਅਲ ਦੇਖੇ ਜਾਂਦੇ ਨੇ ਉਹ ਵੀ ਹਿੰਦੀ ਵਿੱਚ ਹੀ ਦੇਖੇ ਜਾਂਦੇ ਨੇ ਮੇਰੇ ਖੇਤਰ ਵਿੱਚ ਕੰਮ ਕਰਨ ਲਈ ਦੂਜੇ ਰਾਜਾਂ ਦੇ ਲੋਕ ਆਏ ਹੋਏ ਹਨ ਅਤੇ ਉਹ ਆਪਸ ਵਿੱਚ ਆਪਣੀ ਮਾਂ ਬੋਲੀ ਭਾਸ਼ਾ ਵਿੱਚ ਗੱਲ ਕਰਦੇ ਹਨ